ਮੇਰੇ ਹਿਸਾਬ ਨਾਲ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਕਾਜ਼ਾ ਤੋਂ ਮਨਾਲੀ ਆਉਣ ਦੀ ਹੈ ਮੈਂ ਕਾਜ਼ਾ ਤੋਂ ਮਨਾਲੀ ਆਪਣੀ ਗੱਡੀ 'ਤੇ ਆ ਰਿਹਾ ਹਾਂ ਅਤੇ ਕਈ ਸਾਰੀਆਂ ਗੱਡੀਆਂ ਹੋਰ ਆ ਰਹੀਆਂ ਸੀ ਮੇਰੇ ਨਾਲ ਉਹ ਰਸਤੇ ਵਿੱਚ ਬਹੁਤ ਹੀ ਗੰਦੇ ਗੰਦੇ ਨਾਲੇ ਆਉਂਦੇ ਹਨ ਨਾਲੇ ਅਸੀਂ ਇਹਨੂੰ ਕਹਿੰਦੇ ਹਨ ਜਿਹੜੇ ਬਰਫ਼ ਦਾ ਪਾਣੀ ਪਿਘਲ ਕੇ ਸੜਕਾਂ ਤੋਂ ਵੱਗਦਾ ਹੈ ਓ ਪਹਾੜੀ ਇਲਾਕੇ ਵਿੱਚ ਇਹਨਾਂ ਨੂੰ ਗੰ ਨਾਲੇ ਕਹਿੰਦੇ ਹਨ ਉਹ ਨਾਲੇ ਬਹੁਤ ਹੀ ਤੇਜ਼ ਰਫ਼ਤਾਰ ਨਾਲ ਹੁੰਦੇ ਹਨ ਅਤੇ ਉਹਦੇ ਵਿੱਚ ਗੱਡੀ ਲੈ ਕੇ ਜਾਣਾ ਸਮਝੋ ਵੀ ਮੌਤ ਦੇ ਮੂੰਹ ਵਿੱਚ ਗੱਡੀ ਲੈ ਕੇ ਜਾਣਾ ਹੁੰਦਾ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਮੈਂ ਉਨ੍ਹਾਂ ਨਾਲਿਆਂ ਵਿੱਚੋਂ ਬੜੇ ਹੀ ਖੂਬ ਬਖ਼ੂਬੀ ਅਤੇ ਬੜੇ ਹੀ ਇੱਕ ਅ ਅਨੁਭਵੀ ਬੰਦੇ ਦੇ ਡਰਾਈਵਰ ਦੇ ਹਿਸਾਬ ਨਾਲ ਗੱਡੀ ਕੱਢੀਆਂ ਉੱਥੇ ਮੈਂ ਸਿਰਫ ਆਪਣੀ ਗੱਡੀ ਨਹੀਂ ਕੱਢੀ ਉੱਥੇ ਉੱਥੇ ਜਿੰਨੇ ਵੀ ਉੱਥੋਂ ਦੇ ਲੋਕਲ ਡਰਾਈਵਰ ਸੀਗੇ ਕਮਰਸ਼ੀਅਲ ਵੀ ਸੀ ਅਤੇ ਡੋਮੈਸਟਿਕ ਡਰਾਈਵਰ ਵੀ ਸੀਗੇ ਉਨ੍ਹਾਂ ਦੀਆਂ ਵੀ ਸੱਤ ਅੱਠ ਗੱਡੀਆਂ ਮੈਂ ਕੱਢੀਆਂ ਜਦੋਂ ਮੈਂ ਗੱਡੀਆਂ ਕੱਢੀਆਂ ਉਨ੍ਹਾਂ ਨੇ ਮੈਨੂੰ ਬੜਾ ਹੀ ਪਿਆਰ ਕੀਤਾ ਨਾਲ ਉਨ੍ਹਾਂ ਨੇ ਮੈਨੂੰ ਪਾਂਜ ਚਾਰ ਪੰਜ ਪੈੱਗ ਵੀ ਪਿਲਾਏ ਅਤੇ ਮੈਂ ਬੜੇ ਖੁਸ਼ੀ ਖੁਸ਼ੀ ਉਹ ਪੈੱਗ ਪੀਤੇ